ਹਾਂਜੀ ਸਾਡੇ ਇ ਇਲਾਕੇ ਵਿੱਚ ਸੈਲਾਨੀਆਂ ਦੀ ਰਿਹਾਸਤ ਲਈ ਕਮਰੇ ਮਿਲਦੇ ਹਨ ਜਿਸ ਦੇ ਕਿ ਰੇਟ ਬਹੁਤ ਘੱਟ ਹਨ ਅਤੇ ਇਸ ਕਾਰਨ ਲੋਕ ਜ਼ਿਆਦਾ ਦਿਨ ਆਪਣਿਆਂ ਟੂਰ ਉੱਤੇ ਰਹਿ ਸਕਦੇ ਹਨ ਪਰ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਅਤੇ ਸਰਕਾ ਅਤੇ ਉਹ ਬਹੁਤ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ ਜਿੱਥੇ ਅਕਸਰ ਲੋਕ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ ਹਨ ਜੋ ਕਿ ਆਮ ਲੋਕ ਲਈ ਚੰਗੀ ਗੱਲ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਰਕਾਰ ਨੂੰ ਚੰਗੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਹੋਰ ਆਲੇ ਦੁਆਲੇ ਵੀ ਧਿਆਨ ਦੇਣਾ ਚਾਹੀਦਾ ਹੈ